ਗਾਉਣ ਦਾ ਪ੍ਰਦਰਸ਼ਨ ਦਿੰਦੇ ਸਮੇਂ ਜਿੱਥੇ ਸਾਨੂੰ ਆਪਣੇ ਲਫਜ਼ਾਂ ਅਤੇ ਆਪਣੇ ਚਿਹਰੇ ਆਪਣੇ ਸਰੀਰ ਦੇ ਹਾਵਾਂ ਭਾਵਾਂ ਦਾ ਤਾਲਮੇਲ ਬਿਠਾਉਣਾ ਹੁੰਦਾ ਹੈ ਉਸ ਤਰ੍ਹਾਂ ਆਵਾਜ਼ ਦੀ ਹਰਕਤ ਦੇ ਨਾਲ ਸਾਡੇ ਚਿਹਰੇ ਦੇ ਹਾਵ ਭਾਵ ਬਦਲਦੇ ਜਾਂਦੇ ਹਨ ਇਸ ਦੇ ਲਈ ਬਹੁਤ ਅਭਿਆਸ ਦੀ ਲੋੜ ਹੁੰਦੀ ਹੈ ਕਿਉਂਕਿ ਜੇ ਸਾਡੇ ਹਾਵ ਭਾਵ ਸਾਡੀ ਆਵਾਜ਼ ਨਾਲ ਸੰਤੁਲਨ ਖਾਣਗੇ ਤਾਂ ਹੀ ਉਸ ਵਿੱਚੋਂ ਸਾਨੂੰ ਇੱਕ ਚੰਗੇ ਗੀਤਕਾਰ ਚੰਗੇ ਗੀਤ ਦਾ ਪ੍ਰਦਰਸ਼ਨ ਅਸੀਂ ਕਰ ਸਕਦੇ ਹਾਂ ਅਭਿਆਸ ਤੋਂ ਇਲਾਵਾ ਆਪਣੀ ਆਵਾਜ਼ ਨੂੰ ਬਿਹਤਰ ਬਣਾਉਣ ਦੇ ਲਈ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਿਵੇਂ ਕਿ ਠੰਡਾ ਪਾਣੀ ਪੀਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਜ਼ਿਆਦਾਤਰ ਗਰਮ ਜਾਂ ਕੋਸੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ ਖਟਾਈ ਵਾਲੀਆਂ ਚੀਜ਼ਾਂ ਜਿਵੇਂ ਆਚਾਰ ਚਟਨੀ ਇਹਨਾਂ ਸਾਰੇ ਖਾਨਿਆਂ ਖਾਣਿਆਂ ਦੀ ਅਤੇ ਜ਼ਿਆਦਾ ਮਸਾਲੇਦਾਰ ਭੋਜਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹਰੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ ਕਿਉਂਕਿ ਹਰੀ ਮਿਰਚ ਸਾਡੀ ਆਵਾਜ਼ ਨੂੰ ਬਿਹਤਰ ਬਣਾਉਣ ਦੇ ਵਿੱਚ ਸਾਡੀ ਮਦਦ ਕਰਦੀ ਹੈ ਇਹਨਾਂ ਸਾਰੀਆਂ ਗੱਲਾਂ ਦੇ ਨਾਲ ਨਾਲ ਰਿਆਜ਼ ਬਹੁਤ ਜ਼ਰੂਰੀ ਹੈ ਆਪਣੇ ਸੁਰਾਂ ਨੂੰ ਪੱਕਿਆਂ ਕਰਨ ਦੇ ਲਈ ਸਾਨੂੰ ਹਰ ਰੋਜ਼ ਰਿਆਜ਼ ਕਰਨਾ ਚਾਹੀਦਾ ਹੈ ਜਿਸ ਨਾਲ ਸਾਡਾ ਆਤਮ ਬਲ ਵੀ ਵਧੇਗਾ ਸਾਨੂੰ ਆਪਣੇ ਆਪ 'ਤੇ ਆਪਣੀਆਂ ਸੁਰਾਂ 'ਤੇ ਸਾਡੀ ਪਕੜ ਬਣਦੀ ਹੈ